ਛੇ ਅਕਤੂਬਰ ਉੱਨੀ ਸੌ ਸਤਾਨਵੇਂ ਪੱਚੀ ਦਸੰਬਰ ਉੱਨੀ ਸੌ ਸਤਾਨਵੇਂ ਸੱਤ ਜੁਲਾਈ ਉੱਨੀ ਸੌ ਸਤਾਨਵੇਂ ਛੇ ਜਨਵਰੀ ਦੋ ਹਜ਼ਾਰ ਇੱਕ ਸੱਤ ਜਨਵਰੀ ਦੋ ਹਜ਼ਾਰ ਨੌਂ